ਅੱਜ ਕੱਲ੍ਹ ਦਾ ਸਮਾਂ ਪੂਰੀ ਤਰ੍ਹਾਂ ਹੀ ਬਦਲ ਚੁੱਕਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ੍ਹ ਮੋਬਾਈਲਾਂ ਨੇ ਸਾਰੀਆਂ ਖੇਡਾਂ ਛਿਨ ਚੁੱਕਾ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਮੋਬਾਇਲਾਂ 'ਤੇ ਹੀ ਖੇਡਣਾ ਪਸੰਦ ਕਰਦੇ ਹਨ ਮੋਬਾਇਲਾਂ ਦੀਆਂ ਗੇਮਾਂ ਜ਼ਿਆਦਾ ਖੇਡਦੇ ਹਨ ਜਿਵੇਂ ਕਿ ਫਰੀ ਫਾਇਰ ਪੱਬਜੀ ਬੱਚੇ ਇਹਨਾਂ ਜਾ ਇਹਨਾਂ ਨੂੰ ਜ਼ਿਆਦਾ ਖੇਡਣਾ ਪਸੰਦ ਕਰਦੇ ਹਨ ਜਦੋਂ ਕਿ ਪਹਿਲਾਂ ਵਿੱਚ ਬੱਚੇ ਬਾਹਰ ਜਾ ਕੇ ਖੇਡਣਾ ਪਸੰਦ ਕਰਦੇ ਸੀ ਜਿਵੇਂ ਕਿ ਕਬੱਡੀ ਕ੍ਰੀਕੇਟ ਖੋ ਖੋ ਇਹ ਚੀਜ਼ਾਂ ਪਰ ਅੱਜ ਕੱਲ੍ਹ ਦਾ ਸਮਾਂ ਬੱਚਿਆਂ ਨੂੰ ਫੋਨ 'ਤੇ ਜ਼ਿਆਦਾ ਬਤੀਤ ਕਰਨਾ ਚੰਗਾ ਲੱਗਦਾ ਹੈ ਇਸ ਨਾਲ ਬੱਚਿਆਂ ਉੱਤੇ ਬਹੁਤ ਹੀ ਜ਼ਿਆਦਾ ਭੈੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਉਹਨਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ ਕਈ ਬੱਚਿਆਂ ਦੀ ਸ਼ਿਕਾਇਤ ਤਾਂ ਇਹ ਵੀ ਆਉਂਦੀ ਹੈ ਕਿ ਉਹਨਾਂ ਨੂੰ ਸੁਣਨ ਦੀ ਸ਼ਕਤੀ ਵੀ ਘੱਟ ਜਾਂਦੀ ਹੈ ਇਸ ਨਾਲ ਦਿਲ ਦੀਆਂ ਹੋਰ ਵੀ ਬੜੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ ਪਰ ਅੱਜ ਕੱਲ੍ਹ ਦੇ ਬੱਚੇ ਇਹ ਖੇਡਾਂ ਬਹੁਤ ਜ਼ਿਆਦਾ ਖੇਡਦੇ ਹਨ ਜਿਸ ਨਾਲ ਦਿਮਾਗ 'ਤੇ ਵੀ ਅਸਰ ਪੈ ਜਾਂਦਾ ਹੈ ਹੁਣ ਮੈਂ ਤੁਹਾਨੂੰ ਇਹ ਖੇਡਾਂ ਦੱਸਾਂਗਾ ਕਿ ਕਿਹੜੀਆਂ ਬੱਚੇ ਮੁਬਾਇਲ ਉੱਤੇ ਖੇਡਾਂ ਨਵੀਆਂ ਖੇਡਦੇ ਹਨ ਮੰਨ ਲਓ ਪਿਛਲੇ ਜਮਾਨੇ ਵਿੱਚ ਲੋਕ ਲੁੱਡੋ ਖੇਡਦੇ ਸੀ ਲੁਡੋ ਪਹਿਲਾਂ ਇਸ ਤਰ੍ਹਾਂ ਰੱਖ ਕੇ ਚਾਰ ਜਣੇ ਲਾਗੇ ਛਾਗੇ ਬਹਿ ਜਾਂਦੇ ਸਨ ਅਤੇ ਉਹ ਚਾਰ ਵਾਰੀ ਵਾਰੀ ਸਿਰ ਆਪਣੀ ਬਾਟੀ ਚੱਲ ਕੇ ਗੀਟਿਆਂ ਘੁੰਮਾਉਂਦੇ ਸਨ ਪਰ ਅੱਜ ਕੱਲ੍ਹ ਦਾ ਸਮਾਂ ਬਦਲ ਗਿਹਾ ਹੈ ਇਸ ਨਾਲ ਫੋਨ ਵਿੱਚ ਹੀ ਤੁਸੀਂ ਲੁਡੋ ਖੇਡ ਸਕਦੇ ਹੋ ਅਤੇ ਪੂਰੇ ਰੂਲ ਬਦਲ ਗਏ ਹਨ ਪਹਿਲਾਂ ਹੁੰਦਾ ਸੀ ਕਿ ਚਾਰ ਜਣੇ ਖੇਡ ਸਕਦੇ ਸੀ ਪਰ ਅੱਜ ਕੱਲ੍ਹ ਦਾ ਸਮਾਂ ਵਿੱਚ ਫੋਨ ਉੱਤੇ ਛੇ ਤੋਂ ਵੱਧ ਜਣੇ ਵੀ ਖੇਡ ਸਕਦੇ ਹਨ ਇੱਕ ਹੀ ਟਾਈਮ 'ਤੇ ਛੇ ਤੋਂ ਵੱਧ ਜਣੇ ਖੇਡਣ ਤਾਂ ਸਮਾਂ ਵੀ ਜ਼ਿਆਦਾ ਲੱਗਦਾ ਹੈ ਤਾਂ ਉਹ ਛੇ ਜਣੇ ਉਸ ਵਿੱਚ ਰੁਚੀ ਵੀ ਜ਼ਿਆਦਾ ਲੈਂਦੇ ਹਨ ਖੇਡਾਂ ਬਹੁਤ ਵੱਧ ਗਈਆਂ ਹਨ ਫੋਨ ਦੇ ਵਿੱਚ ਹੀ ਬੱਚੇ ਜ਼ਿਆਦਾ ਉਲਝੇ ਰਹਿੰਦੇ ਹਨ ਇਸ ਕਰਕੇ ਇਹ ਖੇਡਾਂ ਨਵੀਆਂ ਬਣ ਚੁੱਕੀਆਂ ਹਨ ਨਵੀਆਂ ਖੇਡਾਂ ਬਹੁਤ ਹੀ ਅੱਗੇ ਵੱਧ ਚੁੱਕੀਆਂ ਹਨ ਓਲੰਪਿਕ ਵਿੱਚ ਵੀ ਇਸ ਦਾ ਬਹੁਤ ਜ਼ਿਆਦਾ ਕਰੇਜ਼ ਵੱਧਦਾ ਜਾ ਰਿਹਾ ਹੈ ਜਿਸ ਨਾਲ ਭਾਰਤ ਬਹੁਤ ਅੱਗੇ ਵੱਧ ਰਿਹਾ ਹੈ ਹੋਰ ਵੀ ਖੇਤਰਾਂ ਦੇ ਬੱਚੇ ਅੱਗੇ ਵੱਧਦੇ ਜਾ ਰਹੇ ਹਨ ਇਹ ਪਰ ਮੋਬਾਇਲ ਦੇ ਵਿੱਚ ਕਈ ਖੇਡਾਂ ਖੇਡਣ ਦੇ ਫ਼ਾਇਦੇ ਵੀ ਹਨ ਇਹ ਟੂਰਨਾਮੈਂਟ ਵੀ ਹੁੰਦੇ ਹਨ ਜਿਸ ਨਾਲ ਬੱਚੇ ਬਹੁਤ ਅੱਗੇ ਵੱਧ ਰਹੇ ਹਨ ਯੂਟਿਊਬ ਇੰਸਟਾਗ੍ਰਾਮ ਉੱਤੇ ਆਪਣੀ ਵੀਡੀਓ ਅਪਲੋਡ ਕਰਦੇ ਹਨ ਜਿਸ ਨਾਲ ਉਹ ਬਹੁਤ ਹੀ ਪੈਸੇ ਵੀ ਕਮਾਉਂਦੇ ਹਨ ਇਸ ਨਾਲ ਉਹਨਾਂ ਨੂੰ ਇਹ ਫ਼ਾਇਦਾ ਹੁੰਦਾ ਹੈ ਕਿ ਉਹ ਪ੍ਰਮੋਸ਼ਨਾਂ ਲੈਂਦੇ ਹਨ ਅਤੇ ਹੋਰ ਕੰਮ ਕਰਦੇ ਹਨ ਜਿਨ੍ਹਾਂ ਨਾਲ ਉਸ ਨੂੰ ਪੈਸੇ ਮਿਲਦੇ ਹਨ ਅਤੇ ਉਹ ਪੈਸੇ ਉਸ ਨੂੰ ਬਹੁਤ ਮਾਤ ਭਾਰੀ ਮਾਤਰਾ ਵਿੱਚ ਦਿੱਤੇ ਜਾਂਦੇ ਹਨ ਜਿਵੇਂ ਕਿ ਮੰਨ ਲੋ ਤੁਸੀਂ ਇੱਕ ਗੇਮ ਨਵੀਂ ਖੇਡਦੇ ਪਏ ਹੋ ਫੋਨ 'ਤੇ ਪਰ ਤੁਸੀਂ ਉਹ ਗੇਮ ਖੇਡਣ 'ਚ ਜ਼ਿਆਦਾ ਰੁਚੀ ਲੈਂਦੇ ਪਏ ਹੋ ਤੇ ਅਤੇ ਤੁਸੀਂ ਉਹਨਾਂ ਦੀ ਵੀਡੀਓ ਬਣਾ ਕੇ ਯੂਟੀਊਬ ਉੱਤੇ ਅਪਲੋਡ ਕਰਦੇ ਪਏ ਹੋ ਇਸ ਨਾਲ ਕੀ ਹੋਵੇਗਾ ਯੂਟੀਊਬ ਤੁਹਾਨੂੰ ਆਪਣੇ ਪੈਸੇ ਦਿੰਦਾ ਜਾਵੇਗਾ ਜਿਸ ਹਿਸਾਬ ਨਾਲ ਤੁਹਾਡੀ ਗੇਮ ਦੀ ਖੇਡਣ ਦੀ ਪ੍ਰਦਰਸ਼ਨੀ ਹੋਵੇਗੀ ਬੱਚੇ ਅੱਜ ਕੱਲ੍ਹ ਫੋਨ ਦੇ ਉੱਤੇ ਗੇਮਾਂ ਖੇਡਣ ਦੇ ਵਿੱਚ ਹੀ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਧੰਨਵਾਦ